ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਜਾਨਵਰਾਂ ਦੀ ਰਹਿੰਦ ਖੂੰਹਦ ਨੂੰ ਪਿੰਡਾਂ ਦੇ ਲੋਕ ਦੇਸੀ ਖਾਦ ਦੀ ਤਰ੍ਹਾਂ ਵਰਤਦੇ ਹਨ ਉਹ ਇਸ ਦੇਸੀ ਖਾਦ ਨੂੰ ਆਪਣੇ ਖੇਤਾਂ ਦੇ ਵਿੱਚ ਪਾ ਕੇ ਆਪਣੀ ਫਸਲ ਨੂੰ ਹੋਰ ਵਧੀਆ ਕਰਨ ਦੇ ਲਈ ਵਰਤਦੇ ਹਨ ਇਸ ਦੇਸੀ ਖਾਦ ਜਾਂ ਫਿਰ ਕਹਿ ਲਉ ਕਿ ਜਾਨਵਰਾਂ ਦੀ ਰਹਿੰਦ ਖੂੰਹਦ ਨੂੰ ਅਸੀਂ ਗੋਬਰ ਗੈਸ ਪਲਾਂਟ ਦੇ ਰਾਹੀਂ ਗੈਸ ਬਣਾਉਣ ਦੇ ਲਈ ਵੀ ਵਰਤ ਸਕਦੇ ਹਨ ਜੋ ਕਿ ਸਾਡੇ ਪਿੰਡਾਂ ਦੇ ਵਿੱਚ ਕਈ ਥਾਵਾਂ 'ਤੇ ਲਗ ਪਲਾਂਟ ਲੱਗੇ ਵੇ ਹੋਏ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰੇ ਪਿੰਡਾਂ ਨੂੰ ਗੈਸ ਮੁਹੱਈਆ ਕਰਵਾਈ ਜਾਂਦੀ ਹੈ